ਹੈਲੋ ਕੀ ਹਾਲ ਹੈ ਕੁਲਦੀਪ ਠੀਕ ਹੈ ਹੋਰ ਕੀ ਬਣਦਾ ਅੱਜ ਕੱਲ੍ਹ ਹਾਂ ਹਾਂ ਹਾਂ ਵਧੀਆ ਵਧੀਆ ਅਤੇ ਕੁਛ ਨਹੀਂ ਬਸ ਉਹ ਹੀ ਪੁੱਛਦਾ ਸੀ ਮੈਂ ਕਿਹਾ ਡਿਗਰੀ ਹੋ ਗਈ ਹੁਣ ਆਪਾਂ ਦੇਖੀਏ ਕੋਈ ਜੋਬ ਜੁਬ ਹੂੰ ਹੂੰ ਹਾਂ ਕਿੱਥੇ ਦੇਖੀਏ ਫਿਰ ਟੀਚਿੰਗ ਦੀ ਦੇਖੀਏ ਹੈਨਾ ਆਪਣਾ ਤਾਂ ਟੀਚਿੰਗ ਆ ਹਾਂ ਅਤੇ ਇੱਧਰ ਰਿਜਿਊਮ ਤਾਂ ਮੈਂ ਬਣਾ ਲਿਆ ਅੱਜ ਅਤੇ ਦੇਈਏ ਫਿਰ ਕੁਛ ਕੁ ਕਾਲਜਾਂ 'ਚ ਜਾ ਕੇ ਆਈਏ ਹੈ ਨਾ ਹਾਂ ਤੇਰਾ ਵੀ ਕਰ ਲੈਦਾਂ ਤਿਆਰ ਆ ਰਿਜਿਊਮ ਬਣਾ ਲੈਂਦੇ ਕੋਈ ਨਹੀਂ ਅਤੇ ਮੈਂ ਕਿਹਾ ਬਈ ਕੱਲ੍ਹ ਨੂੰ ਆਪਾਂ ਚੱਲ ਵੀ ਬੜੀਏ ਯਾਰ ਦੋ ਚਾਰ ਕਾਲਜਾਂ 'ਚ ਇੰਸਟੀਚਿਊਟਾਂ 'ਚ ਜਾ ਆਈਏ ਅੱਛਾ

ਪਰਸੋਂ ਚੱਲ ਵੜਾਂਗੇ ਹੂੰ ਹਾਂ ਨਾਲੇ ਪਤਾ ਕਰ ਲੈਂਦੇ ਹਾਂ ਪਹਿਲਾਂ ਕਿਸੇ ਤੋਂ ਪੁੱਛ ਲੈਂਦੇ ਹਾਂ ਕਿੱਥੇ ਕੋਈ ਹੋਈ ਵੈਕੈਂਸੀ ਖਾਲੀ ਤਾਂ ਉੱਥੇ ਜਾ ਆਵਾਂਗੇ ਅਤੇ ਹੋਰ ਯਾਰ ਨਾਲੇ ਐਕਸਪੀਰੀਅੰਸ ਬਣ ਜਾਉ ਉੱਨਾ ਚਿਰ ਹੂੰ ਹਾਂ ਉੱਨਾ ਚਿਰ ਤਾਂ ਕੋਈ ਆਉਂਦੀ ਨਹੀਂ ਵਕੈਂਸੀ ਸਰਕਾਰੀ ਤਾਂ ਹਾਂ ਹੋਈ ਸੀ ਉਹ ਤਾਂ ਪੀ ਐੱਚ ਡੀ ਦੀ ਤਿਆਰੀ ਕਰਦਾ ਕਹਿੰਦਾ ਜੈਰਫ ਹੋ ਗਈ ਮੈਂ ਪੀ ਐੱਚ ਡੀ ਕਰਨੀ ਆ ਹੂੰ ਹੂੰ ਨਹੀਂ ਹਾਲੇ ਤਾਂ ਮੈਨੂੰ ਲੱਗਦਾ ਕੋਈ ਲੱਗਿਆ ਨਹੀਂ ਯਾਰ ਸਾਰੇ ਘਰ ਸੀਗੇ ਕੇਰਾਂ ਤਾਂ ਹਾਂ ਇਹ ਤਾਂ ਹੈ ਚੱਲ ਦੇਖਦਾ ਹਾਂ ਬਾਕੀ ਆਪਾਂ ਰਿਜਿਊਮ ਦੇ ਕੇ ਕੀ ਬਣਦਾ ਹਾਂ ਠੀਕ ਹੈ ਚੱਲ ਚਲਦੇ ਆ ਫਿਰ ਪਰਸੋਂ ਆ ਜੀ ਠੀਕ ਠੀਕ